ਹਾਂਜੀ ਕੋਂਗਰੈਕਚੁਲੇਸ਼ਨ ਜੀ ਯੂ ਹੈਵ ਬੀਨ ਸਿਲੈਕਟਿਡ ਹਾਂਜੀ ਆ ਹਾਂਜੀ ਅਬ ਅੱਛਾ ਹੁਣ ਤੁਸੀਂ ਕਦੋਂ ਤੋਂ ਜੁਆਇਨ ਕਰ ਰਹੇ ਹੋ ਤੁਹਾਨੂੰ ਅਪੁਆਇੰਟਮੈਂਟ ਲੈਟਰ ਤਾਂ ਮਿਲ ਹੀ ਗਈ ਹੋਣੀ ਆ ਅੱਛਾ ਜੀ ਨਹੀਂ ਇਸ ਤਰ੍ਹਾਂ ਤਾਂ ਨਹੀਂ ਹੋ ਸਕਦਾ ਮੈਨੂੰ ਤਾਂ ਜਿਹੜੇ ਉੱਪਰੋਂ ਆਰਡਰ ਆਏ ਸੀ ਮੈਨੂੰ ਜਿਹੜਾ ਸਰ ਨੇ ਕਿਹਾ ਵੀ ਉਹੀ ਲੈਟਰ ਦੇ ਵਿੱਚ ਮੈਂਸ਼ਨ ਕੀਤਾ ਗਿਆ ਸ਼ਾਇਦ ਤੁਹਾਨੂੰ ਕੋਈ ਗਲਤੀ ਤਾਂ ਨਹੀਂ ਲੱਗ ਰਹੀ ਨਹੀਂ ਮੈਨੂੰ ਪਤਾ ਤੁਸੀਂ ਦੂਰੋਂ ਆਉਣਾ ਵਾ ਇਹ ਤਾਂ ਮੈਂ ਸਮਝਦੀ ਹਾਂ ਅਤੇ ਉਹ ਆਪਾਂ ਮੈਨੂੰ ਤੁਹਾਡੀ ਜਾਂ ਸਰ ਦੀ ਜਿਹੜੀ ਗੱਲ ਹੋਈ ਉਹਦੇ ਬਾਰੇ ਤਾਂ ਕੋਈ ਜਾਣਕਾਰੀ ਹੈ ਨਹੀਂ ਤੁਹਾਡੀ ਸਰ ਨਾਲ ਇੰਟਰਵਿਊ ਦੇ ਵਿੱਚ ਕੀ ਗੱਲ ਹੋਈ ਬਟ ਹਾਂਜੀ ਹਾਂਜੀ ਤੁਸੀਂ ਤੁਹਾਡੀ ਐਕਚੁਲੀ ਤੁਸੀਂ ਸਲੈਕਟ ਹੋਈ ਹੋਈ ਆ ਮੈਡਮ ਇਹ ਗੱਲ ਤਾਂ ਸਹੀ ਹੈ ਤੁਸੀਂ ਜਿੰਨੀ ਸਲੈਕਸ਼ਨ ਉਹ ਤੁਹਾਡੀ ਹੋਈ ਆ ਉਸ ਦੌਰਾਨ ਤੁਹਾਡੀ ਗੱਲ ਹੋਈ ਸੀ ਬਟ ਮੈਂ ਨਾ ਐਕਚੁਲੀ ਸਰ ਦੇ ਨਾਲ ਗੱਲ ਕਰਕੇ ਅਤੇ ਤੁਹਾਨੂੰ ਇੱਕ ਵਾਰੀ ਕਨਫਰਮ ਕਰਕੇ ਦੱਸ ਦਊਗੀ ਕਿ ਤੁਸੀਂ ਇਸ ਤਰ੍ਹਾਂ ਕਹਿ ਰਹੇ ਹੋ ਕਿ ਜਿਹੜੀ ਤੁਹਾਡੇ ਨਾਲ ਸਰ ਨਾਲ ਗੱਲ ਹੋਈ ਸੀ ਉਹ ਤੀਹ ਹਜ਼ਾਰ ਰਿਗਾਰਡਿੰਗ ਹੋਈ ਸੀ ਮੈਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਮੈਨੂੰ ਉਹਨਾਂ ਨੇ ਪੱਚੀ ਹਜ਼ਾਰ ਕਿਹਾ ਸੀ ਅਤੇ ਮੈਂ ਉਹੀ ਲੈਟਰ ਦੇ ਵਿੱਚ ਮੈਨਸ਼ਨ ਕਰਤਾ ਅਤੇ ਹੋ ਸਕਦਾ ਕਈ ਵਾਰ ਕੋਈ ਬਾਏ ਮਿਸਟੇਕ ਵੀ ਕਈ ਵਾਰ ਸੁਣਨ 'ਚ ਗਲਤੀ ਲੱਗ ਜਾਂਦੀ ਹੈ ਮੈਨੂੰ ਹੋ ਸਕਦਾ ਕੋਈ ਇਸ ਤਰ੍ਹਾਂ ਦਾ ਇਸ਼ੂ ਨਾ ਹੋਵੇ ਅਤੇ ਨਹੀਂ ਨਹੀਂ ਉਹ ਕੋਈ ਗੱਲ ਨਹੀਂ ਮੈਡਮ ਉਹਦੇ ਰਿਗਾਰਡਿੰਗ ਤੁਸੀਂ ਐਕਚੁਲੀ ਕਰੋ ਤੁਸੀਂ ਹਾਲੇ ਵੀਹ ਦਿਸੰਬਰ ਨੂੰ ਜੁਆਇਨ ਕਰਨਾ ਨਾ ਉਸ ਤੋਂ ਪਹਿਲਾਂ ਤੁਸੀਂ ਐਕਚੁਲੀ ਇਸ ਤਰ੍ਹਾਂ ਕਰੋ ਅੱਜ ਤਾਂ ਓ ਅੱਜ ਤਾਂ ਜਲਦੀ ਆਫ ਹੋ ਜਾਣਾ ਅਤੇ ਉਸ ਤੋਂ ਬਾਅਦ ਫਿਰ ਦੋ ਦਿਨਾਂ ਦੀ ਛੁੱਟੀ ਆ ਰਹੀ ਹੈ ਠੀਕ ਆ ਅਤੇ ਉਸ ਤੋਂ ਬਾਅਦ ਤੁਸੀਂ ਇਸ ਤਰ੍ਹਾਂ ਕਰੀਓ ਕਿ ਮੰਡੇ ਨੂੰ ਆਇਓ ਅਤੇ ਮੰਡੇ ਨੂੰ ਮੈਂ ਐਡਵਾਂਸ ਦੇ ਵਿੱਚ ਸਰ ਦੇ ਨਾਲ ਗੱਲ ਕਰਕੇ ਰੱਖੂਗੀ ਅਤੇ ਜੇਕਰ ਸਰ ਦਾ ਕੋਈ ਜਿਹੜਾ ਮੈਸੇਜ ਹੈ ਉਹ ਮੈਂ ਤੁਹਾਨੂੰ ਕਨਵੇ ਕਰ ਦਉ ਠੀਕ ਹੈ ਜੀ ਓਕੇ ਜੀ ਓਕੇ ਜੀ ਓਕੇ ਜੀ ਓਕੇ ਸੋ ਵੈਲਕਮ ਜੀ